ਪਕਵਾਨ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹੈ ਜੇ ਸਾਡੀ ਜ਼ਿੰਦਗੀ ਵਿੱਚ ਸੁਆਦਲੇ ਪਕਵਾਨ ਨਾ ਹੋਣ ਤਾਂ ਜ਼ਿੰਦਗੀ ਬੇਰਸ ਬਣ ਜਾਵੇਗੀ ਪਰ ਇਹ ਪਕਵਾਨ ਵੀ ਸਮੇਂ ਦੇ ਵਿਕਾਸ ਦੇ ਨਾਲ ਬਦਲ ਰਹੇ ਹਨ ਸਾਡੀ ਨੌਜਵਾਨ ਪੀੜੀ ਸਧਾਰਨ ਪਕਵਾਨ ਪਸੰਦ ਨਹੀਂ ਕਰਦੀ ਸਗੋਂ ਤਿੱਖੇ ਮਸਾਲੇਦਾਰ ਪਕਵਾਨ ਖਾਂਦੇ ਹਨ ਜਿਵੇਂ ਭਟੂਰੋ ਛੋਲੇ ਕੁਲਚੇ ਛੋਲੇ ਬਰਗਰ ਪੀਜ਼ਾ ਪਾਸਤਾ ਨਿਊਡਲ ਸੋਇਆ ਇਹ ਤਿੱਖੇ ਮਸਾਲੇਦਾਰ ਪਕਵਾਨ ਸਿਹਤ ਲਈ ਹਾਨੀਕਾਰਕ ਹਨ ਪਰ ਅੱਜ ਵੀ ਨੌਜਵਾਨ ਪੀੜੀ ਦੇ ਜੀਭ ਦਾ ਸਵਾਦ ਬਣਨ ਕਰਕੇ ਇਸ ਨੂੰ ਛੱਡ ਨਹੀਂ ਰਹੀ ਇਸ ਦੇ ਨਾਲ ਨਾਲ ਨਾਰੀਅਲ ਅਤੇ ਖੰਡ ਅਜਿਹੇ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਹੋਰ ਵੀ ਸੁਆਦਲੇ ਪਕਵਾਨ ਬਣਾ ਸਕਦੇ ਹਨ ਮਸਾਲਾ ਡੋਸਾ ਵਿੱਚ ਨਾਰੀਅਲ ਦੀ ਚਟਨੀ ਦਾ ਅਨੋਖਾ ਸਵਾਦ ਹੁੰਦਾ ਹੈ ਖੰਡ ਦੀ ਵਰਤੋਂ ਵੀ ਵੱਖਰੇ ਵੱਖਰੇ ਪਕਵਾਨ ਬਣਾਉਣ ਵਿੱਚ ਕੀਤੀ ਜਾਂਦੀ ਹੈ ਜਿਵੇਂ ਕੜਾਹ ਸੇਵੀਆਂ ਬਰਫੀ ਰਸਗੁੱਲੇ ਗੁਲਾਬ ਜਾਮੁਣ ਗਜਰੇਲਾ ਮਿਲਕ ਕੇਕ ਆਦਿ